ਹਾਂਜੀ ਜੀ ਪਟਿਆਲਾ ਟੂਰਿਸਟ ਅੱਛਾ ਜੀ ਅੱਛਾ ਜੀ ਅੱਛਾ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਪਟਿਆਲਾ

ਅੱਛਾ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਤੁਹਾਡਾ ਜੀ ਪਟਿਆਲੇ 'ਚ ਸਵਾਗਤ ਹੈ ਅਤੇ ਸਾਨੂੰ ਫ਼ੋਨ ਕਰਨ ਲਈ ਧੰਨਵਾਦ ਪਟਿਆਲੇ 'ਚ ਜੀ ਬਹੁਤ ਜਗ੍ਹਾਵਾਂ ਨੇ ਜਿਵੇਂ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਹੈਗਾ ਜੀ ਜਿਹਦਾ ਇਤਿਹਾਸ ਬਹੁਤ ਮਸ਼ਹੂਰ ਹੈ ਅਤੇ ਕਾਲੀ ਮਾਤਾ ਮੰਦਰ ਹੋ ਗਿਆ ਜੀ ਬਾਕੀ ਇਹ 'ਚ ਮੋਲ ਵੀ ਹੈਗੇ ਨੇ ਜੀ ਦੋ ਤੁਸੀਂ ਉੱਥੇ ਵੀ ਘੁੰਮ ਸਕਦੇ ਹੋ ਪਾਰਕ ਵੀ ਬਹੁਤ ਨੇ ਜੀ ਇੱਕ ਇਨਵਾਇਰਮੈਂਟ ਪਾਰਕ ਹੋ ਗਿਆ ਜੀ ਬਾਰ੍ਹਾਂ ਦਰੀ ਪਾਰਕ ਹੋ ਗਿਆ ਜੀ ਹਾਂਜੀ ਬਾਕੀ ਪਟਿਆਲੇ ਦੇ ਆਲੇ ਦੁਆਲੇ ਘੁੰਮਣ ਨੂੰ ਵੀ ਬਹੁਤ ਜਗ੍ਹਾਵਾਂ ਨੇ ਜੀ ਬਾਈ ਨੰਬਰ ਫਾਟਕ ਹੋ ਗਿਆ ਉੱਥੇ ਬੜੇ ਰੈਸਟਰੋਂ ਨੇ ਜੀ ਤੁਸੀਂ ਉੱਥੇ ਜਾ ਸਕਦੇ ਹੋ ਹਾਂਜੀ ਹਾਂਜੀ ਤੁਹਾਨੂੰ ਮਿਲ ਸਕਦੇ ਆ ਜੀ ਸ਼ੇਰਾਂ ਆਲੇ ਗੇਟ ਚਲੇ ਜਾਣਾ ਜੀ ਤੁਸੀਂ ਉੱਥੇ ਦਾ ਖਾਣਾ ਬਹੁਤ ਮਸ਼ਹੂਰ ਹੈ ਜੀ ਬਹੁਤ ਪੁਰਾਣੇ ਸ਼ੇਰਾਂ ਵਾਲਾ ਗੇਟ ਜੀ ਸ਼ੇਰਾਂ ਵਾਲੇ ਗੇਟ ਹਾਂਜੀ ਹਾਂਜੀ ਉੱਥੇ ਤੁਹਾਨੂੰ ਬਹੁਤ ਮਸ਼ਹੂਰ ਮਸ਼ਹੂਰ ਪੁਰਾਣੇ ਪੁਰਾਣੇ ਢਾਬੇ ਮਿਲ ਜਾਣਗੇ ਜੀ ਉੱਥੇ ਖਾਣਾ ਬਹੁਤ ਵਧੀਆ ਮਿਲ ਸਕਦਾ ਤੁਹਾਨੂੰ ਬਾਕੀ ਜੇ ਤੁਸੀਂ ਸ਼ੋਪਿੰਗ ਕਰਨੀ ਹੋਵੇ ਤੁਸੀਂ ਬਾਈ ਨੰਬਰ ਜਾ ਸਕਦੇ ਹੋ ਜੀ ਹਾਂਜੀ ਜੀ ਕੋਈ ਗੱਲ ਨਹੀਂ ਅਸੀਂ ਪ੍ਰੋਵਾਈਡ ਕਰ ਦਾਂਗੇ ਜੀ ਗਾਈਡ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਸਾਨੂੰ ਅਜੇ ਇਸ ਨੰਬਰ 'ਤੇ ਮੈਸੇਜ ਕਰ ਦਿਓ ਅਸੀਂ ਤੁਹਾਡੇ ਨਾਲ਼ ਕੰਟੈਕਟ ਕਰ ਲਾਂਗੇ ਜੀ ਅਸੀਂ ਤੁਹਾਨੂੰ ਮੈਸੇਜ 'ਚ ਪੈਕੇਜ ਭੇਜ ਦਾਂਗੇ ਜੀ ਹਾਂਜੀ ਕੋਈ ਨਹੀਂ